ਵੈਸੇ ਤਾਂ ਮੈਨੂੰ ਸਾਰਾ ਕੁਛ ਬਣਾਉਣਾ ਆਉਂਦਾ ਹੈ ਅਤੇ ਜੋ ਹੁਣ ਮੈਂ ਨਵਾਂ ਬਣਾਉਣਾ ਖਾਣਾ ਸਿੱਖਿਆ ਹੈ ਅਤੇ ਪੰਜੀਰੀ ਜਿਹਦੇ ਵਿੱਚ ਪਹਿਲਾਂ ਮੈਂ ਘਿਓ ਲਿਆ ਫਿਰ ਉਹਦੇ ਵਿੱਚ ਮੈਂ ਗਰਮ ਕੀਤਾ ਫਿਰ ਉਹਦੇ 'ਚ ਆਹ ਆਟਾ ਪਾਇਆ ਆਟਾ ਪਾਣ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਭੁੰਨਿਆ ਜਦੋਂ ਉਹ ਲਾਲ ਹੋ ਗਿਆ ਉਹਦੇ ਵਿੱਚ ਮੈਂ ਮਗਜ਼ ਪਾਏ ਉਹਦੇ ਵਿੱਚ ਮੈਂ ਬਦਾਮ ਪਾਏ ਉਹਦੇ ਵਿੱਚ ਮੈਂ ਅਜਵੈਣ ਪਾਈ ਵਿੱਚ ਖਸਖਸ ਪਾਈ ਉਹਦੇ ਵਿੱਚ ਸੁੰਡ ਪਾਈ ਉਹਦੇ ਵਿੱਚ ਕਮਰ ਕਸ ਪਾਈ ਕਤੀਰਾ ਗੂੰਦ ਪਾਇਆ ਅਤੇ ਚੰਗੀ ਤਰ੍ਹਾਂ ਭੁੰਨ ਕੇ ਫੇਰ ਉਸ ਵਿੱਚ ਮੈਂ ਖੰਡ ਪਾਈ ਖੰਡ ਪਾ ਕੇ ਫਿਰ ਉਸਨੂੰ ਵਧੀਆ ਬਣਾ ਕੇ ਫਿਰ ਉਹ ਮੇਰੇ ਬੱਚਿਆਂ ਨੂੰ ਬਹੁਤ ਸਵਾਦ ਲੱਗੀ ਬਹੁਤ ਪਸੰਦ ਆਈ ਕਿ ਜੋ ਕਿ ਵਧੀਆ ਹੈ ਅਤੇ ਜੋ ਹੁਣ ਮੈਂ ਯੂਟਿਊਬ ਤੋਂ ਦੇਖ ਕੇ ਹੀ ਹੋਰ ਸਾਰੇ ਖਾਣੇ ਬਣਾਏ ਕਰਾਂਗੀ ਕਿ ਜੋ ਕਿ ਮੈਨੂੰ ਬਹੁਤ ਵਧੀਆ ਲੱਗਦਾ ਹੈ ਦਾਲ ਹੀ ਵਧੀਆ ਲੱਗਦਾ ਹੈ